ਪ੍ਰਵੇਸ਼ ਦੁਆਰਾਂ ਦੇ ਉੱਤੇ ਗੋਬਰ ਨੂੰ ਪਾਣੀ ਦੇ ਵਿੱਚ ਮਿਲਾ ਕੇ ਛਿੜਕਣ ਦੀ ਇੱਕ ਰਸਮ ਹੈ ਜਿਸ ਜੋ ਕਿ ਬੜੇ ਹੀ ਪੁਰਾਣੇ ਸਮੇਂ ਤੋਂ ਚੱਲੀ ਆ ਰਹੀ ਹੈ ਜਿਸ ਦੇ ਵਿੱਚ ਕੀ ਹੈ ਇਸ ਦਾ ਜੇ ਅਸੀਂ ਕਾਰਣ ਵਿਗਿਆਨਿਕ ਤੌਰ ਦੇ ਉੱਤੇ ਅੱਜ ਦੀ ਘੜੀ ਅਸੀਂ ਸਮਝੇ ਹਾਂ ਤਾਂ ਉਸ ਦਾ ਵੱਡਾ ਕਾਰਣ ਇਹ ਹੈ ਕਿ ਜਦੋਂ ਅਸੀਂ ਗੋਬਰ ਨੂੰ ਪਾਣੀ ਦੇ ਵਿੱਚ ਮਿਲਾ ਕੇ ਪ੍ਰਵੇਸ਼ ਦੁਆਰਾਂ ਦੇ ਉੱਤੇ ਆਪਣੇ ਦਰਵਾਜ਼ਿਆਂ ਦੇ ਉੱਤੇ ਆਪਣੇ ਲਾਂਘੇ ਵਾਲੀ ਥਾਂ ਦੇ ਉੱਤੇ ਜਦੋਂ ਛਿੜਕਦੇ ਹਾਂ ਤਾਂ ਉਸ ਜਗ੍ਹਾ ਨੂੰ ਉਸ ਹਵਾ ਨੂੰ ਉਸ ਥਾਂ ਨੂੰ ਸ਼ੁੱਧੀ ਕਰਨ ਦੇ ਲਈ ਵਰਤਿਆ ਜਾਂਦਾ ਜਦੋਂ ਉਹ ਗੋਬਰ ਆ ਜੋ ਐਂਟੀਬੈਟਿਕ ਹੈ ਜਦੋਂ ਉਹ ਛਿੜਕ ਦਿੱਤਾ ਜਾਂਦਾ ਹੈ ਪਾਣੀ ਦੇ ਵਿੱਚ ਮਿਲਾ ਕੇ ਤਾਂ ਇੱਕ ਅਜਿਹੀਆਂ ਗੈਸਿਸ ਪ੍ਰੋਡਿਊਸ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਕੀ ਨੇ ਮੱਛਰ ਮੱਖੀ ਕੋਈ ਕੀਟਾਣੂ ਜੋ ਨੇ ਉੱਥੋਂ ਦੀ ਜਿਹੜੇ ਨੇ ਉਹ ਅੰਦਰ ਦਾਖਲ ਨਹੀਂ ਹੋ ਸਕਦੇ ਜੇ ਅਸੀਂ ਦੇਖਿਆ ਜਾਵੇ ਇੱਕ ਬੱਚੇ ਦੇ ਜਨਮ 'ਤੇ ਜਿਵੇਂ ਦਰਵਾਜ਼ਿਆਂ ਦੇ ਉੱਪਰ ਇੱਕ ਨਿੰਮ ਬੰਨ ਕੇ ਐਂਟੀਬੈਟਿਕ ਦੇ ਰੂਪ ਦੇ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ ਤਾਂ ਉੱਦਾਂ ਹੀ ਪ੍ਰਵੇਸ਼ ਦੁਆਰਾਂ ਦੇ ਉੱਪਰ ਗੋਹੇ ਦੇ ਵਿੱਚ ਪਾਣੀ ਮਿਲਾ ਕੇ ਜਿਹੜਾ ਹੈ ਉਸ ਨੂੰ ਰਸਮ ਦੇ ਰੂਪ ਦੇ ਵਿੱਚ ਵਰਤਿਆ ਜਾਂਦਾ ਹੈ ਇਸ ਦਾ ਬਸ ਕਾਰਣ ਮੇਨ ਇਹ ਹੀ ਹੈ ਵੀ ਜੋ ਉਸ ਥਾਂ ਨੂੰ ਪਵਿੱਤਰ ਕਰਨ ਦੇ ਲਈ ਸਾਫ਼ ਕਰਨ ਦੇ ਲਈ ਇੱਕ ਇੱਕ ਬੈਕਟੀਰੀਆ ਮੁਕਤ ਕਰਨ ਦੇ ਲਈ ਇਹ ਜਿਹੜੀ ਪ੍ਰਕਿਰਿਆ ਨੂੰ ਕੀਤਾ ਜਾਂਦਾ ਹੈ ਤਾਂ ਇਸ ਦੇ ਪਿੱਛੇ ਵੈਸੇ ਰੂੜੀ ਵਾਦੀ ਸੋਚਾਂ ਨੇ ਤਾਂ ਉਸ ਰੂੜੀਵਾਦੀ ਸੋਚਾਂ ਅੱਜ ਦੇ ਬਦਲਦੇ ਸਮੇਂ ਦੇ ਵਿੱਚ ਸਾਇੰਸਟੀਫਿਕ ਤੌਰ ਦੇ ਉੱਤੇ ਜੇ ਜਿਹੜੀਆਂ ਨੇ ਚੇਂਜ ਹੋ ਚੁੱਕੀਆਂ ਨੇ ਇਹ ਕਲਚਰ ਆ ਇਹ ਜਿਹੜੀਆਂ ਰਸਮਾਂ ਨੇ ਉਹ ਦਿਨ ਦਾ ਦਿਨ ਘੱਟਦੀਆਂ ਜਾ ਰਹੀਆਂ ਨੇ ਸੋ ਧੰਨਵਾਦ